ਹੈਲੋ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ

ਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਇਹ ਹਾਂਜੀ ਤੁਸੀਂ ਕਰ ਸਕਦੇ ਹੋਗੇ ਤੁਸੀਂ ਜਿਹੜੇ ਇਹ ਮੈ ਮਸਾਲੇ ਜਾਂ ਮੈਗੀ ਦੇ ਪੈਕਟ ਵਗੈਰਾ ਸੀ ਖੋਲ੍ਹੇ ਤਾਂ ਨਹੀਂ ਹੈਗੇ ਜਾਂ ਖੋਲ੍ਹ ਕੇ ਚੈੱਕ ਕੀਤੇ ਸੀਗੇ ਹਮ ਹਾਂਜੀ ਤੁਸੀਂ ਨਾ ਮਤਲਬ ਸਾਡੀ ਦੁਕਾਨ 'ਤੇ ਆ ਕੇ ਤੁਸੀਂ ਕਦੇ ਵੀ ਆ ਸਕਦੇ ਦੁਕਾਨ 'ਤੇ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਸਾਡੀ ਦੁਕਾਨ 'ਤੇ ਆ ਕੇ ਕਦੋਂ ਵੀ ਰਿਪਲੇਸ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਤੁਸੀਂ ਜਿਹੜਾ ਉਹ ਸਮਾਨ ਸੀਗਾ ਸਾਰਾ ਇਕੱਠਾ ਕਰਕੇ ਸਾਡੇ ਕੋਲ ਲੈ ਆਇਓ ਅਤੇ ਆ ਕੇ ਤੁਸੀਂ ਜੋ ਵੀ ਤੁਹਾਡੀ ਕੋਲ ਬਿਲ ਬਣਿਆ ਹੋਊਗਾ ਸਾਨੂੰ ਉਹ ਵੀ ਆ ਕੇ ਦਿਖਾ ਦੇਣਾ ਫਿਰ ਅਸੀਂ ਦੇਖ ਲਾਂਗੇ ਮਤਲਬ ਤੁਸੀਂ ਐਕਸਚੇਂਜ ਕਰ ਸਕਦੇ ਹੋਗੇ ਕੋਈ ਪ੍ਰੋਬਲਮ ਨਹੀਂ ਹੈਗੀ ਇਸ 'ਚ ਹਾਂਜੀ ਹਾਂਜੀ ਰਿਪਲੇਸਮੈਂਟ ਪੋਲਿਸੀ ਹੈਗੀ ਆ ਤੁਸੀਂ ਦੁਕਾਨ 'ਤੇ ਆ ਕੇ ਰਿਪਲੇਸ ਕਰ ਸਕਦੇ ਹੋ ਕੋਈ ਗੱਲ ਨਹੀਂ ਤੁਸੀਂ ਲੈ ਆਇਓ ਆਪਾਂ ਚੈੱਕ ਕਰ ਲਾਂਗੇ ਉਹ ਐਕਸਚੇਂਜ ਹੋ ਜਾਣਗੇ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਓਕੇ